ਹਾਂਜੀ ਹਾਂਜੀ ਹਾਂਜੀ ਬੋਲੋ

ਕਦੋਂ ਲੈ ਕੇ ਗਏ ਸੀ ਨਹੀਂ ਮੈਡਮ ਦੇਖੋ ਵਾਪਸ ਤਾਂ ਨੀ ਹੁੰਦਾ ਇਹ ਵਾਪਸ ਨੀ ਕੀਤਾ ਜਾ ਸਕਦਾ ਕੀ ਗੱਲ ਕੀ ਹੋਈ ਆ ਨਹੀਂ ਨਹੀਂ ਮੈਡਮ ਫਿਰ ਵਾਪਸ ਥੋੜ ਹੋਊਗਾ ਉਹ ਤਾਂ ਪਹਿਲਾਂ ਤੁਸੀਂ ਦੇਖ ਲੈਣਾ ਸੀ ਨਹੀਂ ਨਹੀਂ ਬਦਲੀ ਨਹੀਂ ਜਾਂਦੀ ਚੀਜ਼ ਹਾਂ ਵਾਪਸ ਨਹੀਂ ਕੀਤੀ ਜਾ ਸਕਦੀ ਆ ਜੇ ਕੋਈ ਉਹਦੇ ਚ ਪ੍ਰੋਬਲਮ ਆਈ ਆ ਤੇ ਉਹਨੂੰ ਆਪਾਂ ਬਦਲ ਸਕਦੇ ਆਂ ਤੇ ਵਾਪਸ ਨਹੀਂ ਕੀਤੀ ਜਾ ਸਕਦੀ ਨਹੀਂ ਨਹੀਂ ਉਹੀ ਉਹੀ ਮਿਲ ਜਾਊਗੀ ਹੋਰ ਤਾਂ ਨਹੀਂ ਹੈਗੀ ਉਹਨੂੰ ਚੇਂਜ ਕੀਤਾ ਜਾਂਦਾ ਪਰ ਰਸੀਦ ਤੁਹਾਡੇ ਕੋਲੇ ਹੈਗੀ ਕੋਈ ਉਹਦਾ ਹੈਗਾ ਪਰੂਫ ਹਾਂ ਬਈ ਰਸੀਦ ਤੋਂ ਬਗੈਰ ਅਸੀਂ ਫੇਰ ਕਰ ਸਕਦੇ ਆਂ ਰਸੀਦ ਤੋਂ ਬਗੈਰ ਨਹੀਂ ਕਰ ਸਕਦੇ ਨਹੀਂ ਉਹ ਉਹਦਾ ਕਲਰ ਚੇਂਜ ਕਰਨਾ ਕੋਈ ਹੋਰ ਚੀਜ਼ ਕਰਨੀ ਹ ਕਿ ਉਹਨੂੰ ਕੋਈ ਕੀ ਪ੍ਰੋਬਲਮ ਆਈ ਉਹਨੂੰ ਠੀ ਠੀਕ ਆ ਨੀ ਰੀਫੰਡ ਦੀ ਪੋਲਸੀ ਆਪਣੇ ਕੋਲ ਹੈ ਨਹੀਂ ਨਾ ਆਪਾਂ ਉਹਨੂੰ ਦੋ ਨਹੀਂ ਕਰ ਸਕਦੇ ਹਾਂ ਨੀ ਹੈ ਨੀ ਨਾ ਕਰ ਸਕਦੇ ਸਾ ਸਾਡਾ ਉਹ ਵੈ ਉਹ ਬਿਲ ਤੁਸੀਂ ਦੇਖਣਾ ਸੀ ਨਾ ਬਿਲ ਤੇ ਲਿਖਿਆ ਹੋਇਆ ਹੈਗਾ ਵਾ ਵੀ ਚੀਜ਼ ਉਹਨੂੰ ਵਾਪਸ ਨਹੀਂ ਕੀਤੀ ਜਾ ਸਕਦੀ ਉਹ ਬਿੱਲ ਤੇ ਲਿਖਿਆ ਹੋਇਆ ਬਕਾਇਦਾ ਜੋ ਬਿਲ ਥੋਨੂੰ ਕੱਟ ਕੇ ਦਿੱਤਾ ਉਹ ਬਿਲ ਤੇ ਲਿਖਿਆ ਹੋਇਆ ਪਿਛਲੇ ਪਾਸੇ ਲਿਖੋ ਲਿਖਿਆ ਥੱਲੇ ਵੀ ਚੀਜ਼ ਉਹਦਾ ਵਾਪਸ ਪੈਸੇ ਵਾਪਸ ਨਹੀਂ ਕੀਤੇ ਜਾ ਸਕਦੇ ਨਹੀਂ ਨਹੀਂ ਮੈਡਮ ਉਹ ਤੁਹਾਨੂੰ ਭੁਲੇਖਾ ਪੈ ਗਿਆ ਵਾਪਸ ਨਹੀਂ ਗਾ ਬਦਲਿਆ ਜਾ ਸਕਦਾ ਵਾ ਉਹ ਜੇ ਤੁਹਾਡੇ ਕੋਲ ਰਸੀਦ ਹੋਈ ਉਹ ਚੀਜ਼ ਰੱਖ ਜੋ ਉਹਦੇ ਨਾਲ ਹੋਰ ਲੈ ਜਾਓ ਪਰ ਉਹਦੇ ਨਾਲ ਵੀ ਪੈਸੇ ਸਾਨੂੰ ਹੋਰ ਐਕਸਟਰਾ ਲੱਗਣਗੇ ਨਹੀਂ ਨਾ ਬੱਚਿਆਂ ਨੂੰ ਉਹਨਾਂ ਨੂੰ ਨਹੀਂ ਪਤਾ ਬਿੱਲ ਤੇ ਬਕਾਇਦਾ ਲਿਖਿਆ ਹੋਇਆ ਉਹ ਚੀਜ਼ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਸਕਦੇ ਹਾਂ ਜੇ ਕੋਈ ਉਹਨੂੰ ਡਿਜ਼ਾਇਨ ਦੀ ਗੱਲ ਨਹੀਂ ਹੈਗੀ ਜੇ ਕੋਈ ਉਦਾਂ ਕੋਈ ਪ੍ਰੋਬਲਮ ਆਈ ਆ ਉਹ ਚੀਜ਼ ਨੂੰ ਬਦਲਿਆ ਜਾ ਸਕਦਾ ਪਰ ਉਹਦੇ ਪੈਸੇ ਅਲੱਗ ਲੱਗਣਗੇ ਹੋਰ ਕਿਉਂਕਿ ਉਸ ਤੋਂ ਵਧੀਆ ਚੀਜ਼ ਦੇਵਾਂਗੇ ਅਸੀਂ ਉਹਦਾ ਖਰਚਾ ਤਾਂ ਵੱਧ ਪਊਗਾ ਹੀ

ਉਹ ਤਾਂ ਥੋਨੂੰ ਖਰਚਾ ਪੈਣਾ ਹੀ ਸੀ ਖਰਚਾ ਉਹ ਤਾਂ ਪੈਣਾ ਹੀ ਆ ਤੁਹਾਨੂੰ ਕਿਉਂਕਿ ਤੁਸੀਂ ਚੀਜ਼ ਖਰੀਦੀ ਆ ਦੇਖੋ ਉਹਦਾ ਖਰਚਾ ਤਾਂ ਪੈਣਾ ਓਕੇ